ਕਿਫਾਈਤੀ ਆਵਾਜਾਈ ਦੀ ਘਾਟ ਦੇ ਨਾਲ ਜਿੱਦਾਂ ਕਿ ਬਹੁਤ ਵੱਡੀ ਇੱਕ ਸਮੱਸਿਆ ਇਹ ਹੁੰਦੀ ਹੈ ਕਿ ਜਿਹੜੇ ਲੋਕ ਹੈ ਉਹ ਬਿਲਕੁਲ ਪ੍ਰਭਾਵਿਤ ਹੁੰਦੇ ਨੇ ਜਿੱਦਾਂ ਇੱਥੇ ਇਹ ਸਾਡੇ ਸ਼ਹਿਰ ਮੈਟਰੋ ਨਾ ਹੋਣ ਕਰਕੇ ਬਹੁਤ ਇੱਕ ਤਾਂ ਰਸ਼ ਦੀ ਪ੍ਰੋਬਲਮ ਟਰੈਫਿਕ ਦੀ ਪ੍ਰੋਬਲਮ ਸਭ ਤੋਂ ਵੱਡੀ ਸਮੱਸਿਆ ਤਾਂ ਇਹ ਹੁੰਦੀ ਹੈ ਅਤੇ ਜਿਹੜੇ ਇਹ ਕਸਬਿਆਂ 'ਚ ਛੋਟੇ ਛੋਟੇ ਕਸਬਿਆਂ 'ਚ ਰਹਿ ਰਹੇ ਹੁੰਦੇ ਨੇ ਅਤੇ ਉਹਨਾਂ ਨੂੰ ਜਦੋਂ ਹੈ ਆਵਾਜਾਈ ਦੇ ਸਾਧਨ ਨਹੀਂ ਮਿਲਦੇ ਉਦੋਂ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੇ ਨੇ ਇਸ ਚੀਜ਼ ਨਾਲ ਕਿਉਂਕਿ ਜਦੋਂ ਜੇ ਜਿਹੜੀ ਜਗ੍ਹਾ ਵਜੇ ਜਿਹੜੇ ਕਸਬਿਆਂ 'ਚ ਕੋਈ ਸਾਧਨ ਹੀ ਨਹੀਂ ਹੈ ਕੁਛ ਜਾਣ ਦਾ ਆਉਣ ਜਾਣ ਦਾ ਇੱਕ ਤਾਂ ਉੱਥੇ ਹੋਸਪਿਟਲਸ ਕਨੈਕਟ ਨਹੀਂ ਹੋ ਪਾਉਂਦੇ ਜੇ ਜਿੱਥੇ ਸੜਕਾਂ ਤੱਕ ਨਹੀਂ ਹੈ ਜਿਹੜੇ ਕਸਬਿਆਂ 'ਚ ਉਹਨਾਂ ਨੂੰ ਇਹ ਸਮੱਸਿਆ ਆਉਂਦੀ ਹੈ ਕਿ ਜਿਵੇਂ ਵਿਚਾਰਿਆਂ ਨੂੰ ਕੰਮ 'ਤੇ ਜਾਣਾ ਵੈ ਕੋਈ ਕੰਮ ਲੱਭਣਾ ਵੈ ਸਕੂਲ ਜਾਣਾ ਪੜ੍ਹਨ ਲਿਖਣ ਜਾਣਾ ਅਤੇ ਉਹਨਾਂ ਨੂੰ ਬੜੀ ਦੂਰ ਦੂਰ ਆਉਣਾ ਪੈਂਦਾ ਉਸ ਚੀਜ਼ ਲਈ ਅਤੇ ਕਿਉਂਕਿ ਕਿਫਾਇਤੀ ਆਵਾਜਾਈ ਦੀ ਘਾਟ ਹੈ ਅਤੇ ਲੋਕ ਕਈ ਲੋਕ ਤਾਂ ਇਹ ਕੰਮ ਤੋਂ ਪਿੱਛੇ ਰਹਿ ਜਾਂਦੇ ਨੇ ਉਹ ਵਿਚਾਰੇ ਕਰ ਹੀ ਨਹੀਂ ਪਾਉਂਦੇ ਅਤੇ ਜਿਸ ਨਾਲ ਕਿ ਬਹੁਤ ਸਿੱਖਿਆ ਪ੍ਰਭਾਵਿਤ ਹੁੰਦੀ ਹੈ ਕੀ ਹੁੰਦਾ ਕਿ ਨੌਕਰੀ ਵੀ ਨੌਕਰੀ ਦੇ ਮੌਕੇ ਨਹੀਂ ਮਿਲਦੇ ਲੋਕਾਂ ਨੂੰ ਕਿਉਂਕਿ ਕਈ ਆਪਣੇ ਘਰਾਂ ਨੂੰ ਛੱਡ ਕੇ ਇੰਨੀ ਦੂਰ ਦੂਰ ਨਹੀਂ ਰਹਿਣ ਜਾ ਸਕਦੇ ਕਈ ਆਪਣੇ ਘਰ ਨਹੀਂ ਛੱਡ ਕੇ ਜਾ ਸਕਦੇ ਅਤੇ ਜਦੋਂ ਉਹ ਗੱਲ ਆਉਂਦੀ ਹੈ ਸਿਹਤ ਸੰਭਾਲ ਦੀ ਤਾਂ ਜਿਹੜੇ ਚੰਗੇ ਚੰਗੇ ਹੋਸਪੀਟਲ ਹੁੰਦੇ ਨੇ ਉਹ ਸਾਰੇ ਦੂਰ ਦੂਰ ਹੁੰਦੇ ਨੇ ਅਤੇ ਕਈ ਵਾਰੀ ਕਿਸੇ ਨੂੰ ਉਸੇ ਟਾਈਮ ਇਲਾਜ ਦੀ ਲੋੜ ਹੁੰਦੀ ਹੈ ਅਤੇ ਜਦੋਂ ਇਹ ਕਿਫਾਇਤੀ ਆਵਾਜਾਈ ਦੇ ਸਾਧਨ ਉੱਥੇ ਨਹੀਂ ਹੁੰਦੇ ਅਤੇ ਕਈ ਵਰੀ ਬਹੁਤ ਨੁਕਸਾਨ ਹੋ ਜਾਂਦਾ ਹੈ